ਹੈਲੋ

ਹਾਂਜੀ ਕਿੱਥੇ ਹੈਗੇ ਓ ਮੈਂ ਨਾ ਆਪਣੇ ਘਰ ਦਾ ਜਿਹੜਾ ਹੈਗਾ ਸੀਗਾ ਕਮਰੇ ਦੇ ਬਾਰੀਆ ਨੂੰ ਨੂੰ ਸਫਾਈ ਵਾਸਤੇ ਕਿਹਾ ਸੀਗਾ ਤੁਹਾਨੂੰ ਤੇ ਤੁਸੀਂ ਫਿਰ ਕਰਵਾਇਆ ਨੀ ਫਿਰ ਉਹਨੂੰ ਬੁਲਾਇਆ ਨੀ ਠੀਕ ਠੀਕ ਬੜੇ ਦਿਨ ਹੋ ਗਏ ਜੀ ਕੰਮ ਬੜਾ ਮੁਸ਼ਕਿਲ ਹੋਇਆ ਪਿਆ ਠੀਕ ਅੱਛਾ ਠੀਕ ਐ ਹਾਂਜੀ ਅੱਛਾ ਹਾਂਜੀ ਅੱਛਾ ਹਾਂ ਇਕ ਦੋ ਕੰਮ ਹੈਗੇ ਨੇ ਜਿਹੜੇ ਕਰਨੇ ਜਰੂਰੀ ਨੇ ਨਾ ਆਪਣੇ ਫਿਰ ਕੰਮ ਕਿਵੇਂ ਚੱਲੇਗਾ ਬੜੇ ਦਿਨਾਂ ਦਾ ਆਹ ਫਰਿਜ ਦਾ ਵੀ ਫਰਿੱਜ ਵੀ ਖਰਾਬ ਹੋਇਆ ਪਿਆ ਠੀਕ ਠੀਕ ਫਿਰ ਠੀਕ ਹ ਜੀ ਚਲੋ ਹੁਣ ਜਲਦੀ ਕਹਿ ਰਹੇ ਥੋੜਾ ਕਰ ਦੇਵੇ ਹਾਂ ਹਾਂਜੀ ਚਲੋ ਅੱਛਾ ਹਾਂਜੀ ਹਾਂਜੀ ਠੀਕ ਐ ਜੀ ਠੀਕ ਹ ਚਲੋ ਠੀਕ ਹ ਸਵੇਰੇ ਹੁਣ ਕਹਿ ਦਿਆ ਜੇ ਜਰੂਰ ਠੀਕ ਹ ਜੀ ਹਾਂ ਸਵੇਰੇ ਕਰਵਾ ਦਿਆ ਜੇ ਯਾਦ ਠੀਕ ਹ ਠੀਕ